ਹੈਲੋ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਕੈਬ ਸਰਵਿਸ ਤੋਂ ਬੋਲ ਰਹੇ ਹੋ ਜੀ ਭਾਅ ਜੀ ਇੱਕ ਨਾ ਪੰਜ ਸਤੰਬਰ ਦੋ ਹਜ਼ਾਰ ਤੇਈ ਨੂੰ ਆਪਾਂ ਨੇ ਸੈਕਟਰ ਸਤਾਰ੍ਹਾਂ ਤੋਂ ਬੋਲ ਰਿਹਾ ਭਾਅ ਜੀ ਮੈਂ ਅਤੇ ਅੰਮ੍ਰਿਤਸਰ ਜਾਣਾ ਭਾਅ ਜੀ ਪਰਿਵਾਰ ਦੇ ਮੇਰੇ ਦੇ ਤਿੰਨ ਮੈਂਬਰ ਨੇ ਅਤੇ ਸਵੇਰੇ ਛੇ ਕੁ ਵਜੇ ਤੁਸੀਂ ਪਹੁੰਚ ਜਾਉਂਗੇ ਜੀ ਅੰਮ੍ਰਿਤਸਰ ਜਾਣਾ ਭਾਅ ਜੀ ਆਪਾਂ ਨੇ ਅਤੇ ਉਸੇ ਦਿਨ ਆਪਾਂ ਨੇ ਵਾਪਸ ਵੀ ਆਉਣਾ ਜੀ ਅਤੇ ਆਪਣਾ ਜਿਹੜਾ ਰੈਂਟ ਹੈ ਤੁਹਾਡਾ ਉਹ ਕਿੰਨਾ ਉਹ ਦੱਸ ਦਿਉ ਮੈਨੂੰ ਅਤੇ ਸਵੇਰੇ ਨਾ ਭਾਅ ਜੀ ਪਲੀਜ਼ ਜਲਦੀ ਛੇ ਕੁ ਵਜੇ ਦੇ ਕਰੀਬ ਪਹੁੰਚ ਜਿਓ ਪੰਜ ਤਰੀਕ ਨੂੰ ਠੀਕ ਹੈ ਜੀ ਧੰਨਵਾਦ ਜੀ